ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਅੱਜ ਤੋਂ ਤਕਰੀਬਨ ਪੰਜ ਸੱਤ ਸਾਲ ਪਹਿਲਾਂ ਵੈਸ਼ਨੋ ਦੇਵੀ ਦੀ ਯਾਤਰਾ ਕੀਤੀ ਸੀ ਉੱਥੇ ਇਕੱਤੀ ਦਸੰਬਰ ਨੂੰ ਮਿੰਨੀ ਚੰਚਲ ਜੀ ਦੁਆਰਾ ਜਾਗਰਣ ਕੀਤਾ ਜਾਂਦਾ ਹੈ ਉਸ ਜਾਗਰਣ 'ਤੇ ਮੈਂ ਇੱਕ ਵਾਰ ਸ਼ਿਰਕਤ ਕੀਤੀ ਹੈ ਉੱਥੇ ਬਹੁਤ ਹੀ ਵਧੀਆ ਮਾਹੌਲ ਸੀ ਜਿਸ ਵਿੱਚ ਬਹੁਤ ਹੀ ਵੱਡਾ ਮੇਲਾ ਲੱਗਿਆ ਹੋਇਆ ਸੀ ਬੜੀ ਦੁਨੀਆ ਦੂਰ ਦੂਰ ਤੋਂ ਆਈ ਹੋਈ ਸੀ ਘੱਟ ਤੋਂ ਘੱਟ ਡੇਢ ਤੋਂ ਦੋ ਲੱਖ ਬੰਦਾ ਹੈਗਾ ਸੀ ਉੱਥੇ ਆਪਾਂ ਨੂੰ ਬੜਾ ਹੀ ਆਨੰਦ ਮਹਿਸੂਸ ਹੋਇਆ ਮਾਤਾ ਰਾਣੀ ਨੇ ਬੜਾ ਹੀ ਸਾਡਾ ਮਾਣ ਸਤਿਕਾਰ ਪਿਆਰ ਦੁਲਾਰ ਸਾਨੂੰ ਮਿਲਿਆ ਉੱਥੇ ਸਾਨੂੰ ਫ੍ਰੀ 'ਚ ਲੰਗਰ ਮਿਲਿਆ ਲੰਗਰ ਬੜਾ ਹੀ ਸਵਾਦ ਅਤੇ ਮਾਤਾ ਦਾ ਆਸ਼ੀਰਵਾਦ ਨਾਲ ਭਰਪੂਰ ਸੀ ਉੱਥੇ ਸਾਨੂੰ ਕਈ ਤਰ੍ਹਾਂ ਦੇ ਹੋਰ ਵੀ ਸਟੋਲ ਵਗੈਰਾ ਮਿਲੇ ਜਿਸ ਨੂੰ ਖਾ ਕੇ ਅਸੀਂ ਬਹੁਤ ਹੀ ਤ੍ਰਿਪਤ ਹੋਏ ਉੱਥੇ ਸਾਨੂੰ ਬੜਾ ਹੀ ਮਜ਼ਾ ਆਇਆ ਉੱਥੇ ਜੋ ਸੀ ਭੇਟਾਂ ਸੁਣ ਕੇ ਅਸੀਂ ਬੜਾ ਹੀ ਆਨੰਦਮਈ ਹੋ ਗਏ ਅਸੀਂ ਆਪਣਾ ਸਾਰਾ ਦਿਲ ਪਰਚਾਵਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਸਾਡੇ ਨਾਲ ਹੋਰ ਵੀ ਕਈ ਲੋਕ ਸੀ ਜਿਨ੍ਹਾਂ ਨਾਲ ਜੈਕਾਰੇ ਭਰਪੂਰ ਲਗਾ ਰਹੇ ਸਨ ਜੈਕਾਰਾ ਮਾਂ ਸ਼ੇਰਾਂ ਵਾਲੀ ਦਾ ਬੋਲਦਿਆਂ ਹੋਇਆ ਸਾਡਾ ਦਿਨ ਕਿਸ ਤਰ੍ਹਾਂ ਚੜ੍ਹ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ